ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਹਨ ਜੋ ਜੋ ਕਿ ਅਸਧਾਰਨ ਸ਼ਬਦ ਦਾ ਹਨ ਜਿਵੇਂ ਕਿ ਵਾਕੰਸ਼ ਵਾਕ ਮਹਾਵਰੇ ਇੱਦਾਂ ਦੇ ਬਹੁਤ ਤਰ੍ਹਾਂ ਦੇ ਸਬਦ ਹਨ ਜਿਵੇਂ ਕਿ ਰਾਈ ਦਾ ਪਹਾੜ ਬਣਾਉਣਾ ਨਿੱਕੀ ਜਿਹੀ ਗੱਲ ਨੂੰ ਵਧਾ ਚੜਾਅ ਦੇ ਵਧਾਉਣਾ ਰੇਖਾ ਵਿੱਚ ਮੇਖ ਮਨਾਲੀ ਕਸਣਾ ਅਤੇ ਚੰਗੀ ਤਰ੍ਹਾਂ ਦੇਣਾ ਇਸ ਤਰ੍ਹਾਂ ਦੇ ਹੋਰ ਸ਼ਬਦ ਹਨ ਜਿਵੇਂ ਕਿ ਰਗੜ ਰਗੜਨ ਚੜਨੀ ਰਗੜਨ ਚੜਨੀ ਰਵਾ ਰਵੀ ਅਤੇ ਮਤਲਬ ਰਿਓੜੀ 'ਤੇ ਫੇਰਨਾ ਵਿੱਚ ਆਉਣਾ ਕਿਸੇ ਵੀ ਮੁਸੀਬਤ ਦੇ ਵਿੱਚ ਫਸ ਜਾਣਾ ਆਰਾਮ ਰੌਲਾ ਰਬੜ ਅਸਾਨਤੀ ਇਸ ਤਰ੍ਹਾਂ ਦੇ ਹੋਰ ਬਹੁਤ ਸ਼ਬਦ ਹਨ ਮਹਾਵਰੇ ਵਾਕੰਸ਼ ਜਿਵੇਂ ਕਿ ਮੁੰਹਾਂ ਫੁੱਲ ਕਿਰਨਾ ਮੂੰਹੋਂ ਫੁੱਲ ਕਿਰਨੇ ਮੂਗ ਹੋ ਜਾਣਾ ਮੂੰਹ ਮਹੌਲ ਲਲਚਾਉਣਾ ਮੂੰਹ ਵਿੱਚ ਘੁੰਗਣੀ ਮੂਲੀ ਪੱਟਿਆ ਟੋਇਆ ਹੋਣਾ ਮੁਛਾਂ ਦੇ ਭਾਵ ਹੋਣੇ ਮਾਰੋ ਮਾਰੀ ਕਰਨਾ ਮੱਥਾ ਡਮਣਾ ਮੱਥਾ ਠਾਠਣਾ ਦੁਰ ਫਿੱਟੇ ਮੂੰਹ ਇੱਦਾਂ ਦੇ ਬਹੁਤ ਸਾਰੇ ਸ਼ਬਦ ਹਨ ਇਹ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਜਾਗਰੂਕਤਾ ਬਣਾਈ ਰੱਖਦੇ ਹਨ